ਭੰਗੜਾ ਪੰਜਾਬ ਦਾ ਇੱਕ ਪ੍ਰਸਿੱਧ ਲੋਕ ਨਾਚ ਹੈ ਇਸ ਨੂੰ ਪੁਰਾਣੇ ਸਮੇਂ ਤੋਂ ਭੰਗੜੇ ਨਾਲ ਨੱਚਿਆ ਜਾਂਦਾ ਲੋਕ ਪੁਰਾਣੇ ਸਮੇਂ ਵਿੱਚ ਵੀ ਭੰਗੜਾ ਹੀ ਪਾਉਂਦੇ ਸਨ ਪਰ ਹੁਣ ਇਹਨੂੰ ਇਸ ਤੋਂ ਜ਼ਿਆਦਾ ਮਹੱਤਵ ਦਿੱਤੀ ਜਾਂਦੀ ਹੈ ਲੋਕ ਅੱਜ ਕੱਲ੍ਹ ਪਾਰਟੀਆਂ 'ਚ ਵੀ ਭੰਗੜੇ ਦਾ ਇਸਤੇਮਾਲ ਕਰਦੇ ਹਨ ਲੋਕ ਵਿਆਹ ਸ਼ਾਦੀਆਂ ਅਤੇ ਲੋਹੜੀ ਮਾਘੀ ਸਭ 'ਤੇ ਭੰਗੜੇ ਦਾ ਇਸਤੇਮਾਲ ਕਰਦੇ ਹਨ ਕੁੜੀਆਂ ਮੁੰਡੇ ਦੋਨੋਂ ਹੀ ਇੰਨਾ ਭੰਗੜੇ ਦਾ ਇਸਤੇਮਾਲ ਕਰਦੇ ਆ ਕੁੜੀਆਂ ਸਲਵਾਰ ਸੂਟ ਸੱਗੀ ਫੁੱਲ ਮੁੰਡੇ ਕੁੜਤਾ ਪਜਾਮਾ ਟੋਰੇ ਦੀ ਪੱਗ ਬੰਨ੍ਹਦੇ ਹਨ ਅਤੇ ਭੰਗੜਾ ਪਾਉਂਦੇ ਹਨ ਅਤੇ ਉਹਨਾਂ ਨੂੰ ਔਨਲਾਈਨ ਪਾ ਦਿੰਦੇ ਹਨ ਅਤੇ ਵੀਡੀਓ ਪਾਉਂਦੇ ਹਨ ਅਤੇ ਕੋਚਾਂ ਤੋਂ ਸਿੱਖ ਕੇ ਭੰਗੜਾ ਸਿੱਖਦੇ ਹਨ ਅਤੇ ਲੋਕ ਅੱਜ ਕੱਲ੍ਹ ਬਾਹਰ ਵੀ ਇੰਨਾ ਭੰਗੜੇ ਨੂੰ ਮਹੱਤਵ ਦਿੰਦੇ ਹਨ ਲੋਕ ਨਾਚ ਬਣ ਗਿਆ ਭੰਗੜਾ ਮੈਂ ਨਹੀਂ ਸਮਝਦੀ ਕਿ ਇੱਦੂ ਬਾਅਦ ਭੰਗੜੇ ਦੀ ਜ਼ਿਆਦਾ ਹੀ ਮਹੱਤਵ ਦਿੱਤੀ ਜਾਵੇ ਦਿੱਤੀ ਜਾਂਦੀ ਹੈ ਲੋਕ ਅੱਜ ਕੱਲ੍ਹ ਬੱਚੇ ਵੀ ਛੋਟੇ ਛੋਟੇ ਭੰਗੜਾ ਪਾਉਂਦੇ ਹਨ ਕੋਈ ਪਾਰਟੀ ਹੋਵੇ ਵਿਆਹ ਹੋਵੇ ਸ਼ਾਦੀ ਹੋਵੇ ਸਾਰੇ ਹੀ ਭੰਗੜੇ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ ਅੱਜ ਕੱਲ੍ਹ ਜ਼ਿਆਦਾ ਹੀ ਭੰਗੜੇ ਦਾ ਇਸਤੇਮਾਲ ਕੀਤਾ ਜਾਂਦਾ ਲੋਕ ਪਾਰਟੀਆਂ ਵਿੱਚ ਵੀ ਇਹਨੂੰ ਜ਼ਿਆਦਾ ਭੰਗੜਾ ਹੀ ਪਾਇਆ ਜਾਂਦਾ ਹੈ ਲੋਕ ਸਕੂਲਾਂ ਵਿੱਚ ਸਕੂਲਾਂ ਵਿੱਚ ਵੀ ਭੰਗੜੇ ਦਾ ਪ੍ਰੋਗਰਾਮ ਕਰਵਾਉਂਦੇ ਹਨ ਕੁੜੀਆਂ ਮੁੰਡੇ ਸਾਰੇ ਨੱਚਦੇ ਹਨ ਅਤੇ ਬੱਚੇ ਅੱਗੇ ਮੈਂ ਆਪਣੇ ਬੇਟੇ ਨੂੰ ਵੀ ਕੋ ਭੰਗੜਾ ਹੀ ਸਿਖਾਉਂਦੀ ਹਾਂ ਅਤੇ ਕੋਚਾਂ ਤੋਂ ਸਿਖਾਉਂਦੀ ਹਾਂ ਅਤੇ ਉਹ ਰੋਜ਼ ਆ ਕੇ ਮੈਨੂੰ ਆਪਣੇ ਭੰਗੜੇ ਦੇ ਸਟੈਪ ਵਗੈਰਾ ਰੋਜ਼ ਦੱਸਦਾ ਅਤੇ ਰੋਜ਼ ਸੁਬਹਾ ਉੱਠ ਕੇ ਭੰਗੜਾ ਸਿੱਖਣ ਲਈ ਕੋਚ ਕੋਲ ਜਾਂਦਾ ਅਤੇ ਭੰਗੜਾ ਸਿੱਖ ਕੇ ਆਉਂਦਾ ਹੈ ਅਤੇ ਆਪਣੇ ਸਕੂਲ ਵਿੱਚ ਜਾ ਕੇ ਟਾਈਮ ਬਿਤਾਉਂਦਾ ਹੈ ਅਤੇ ਬਾਅਦ ਵਿੱਚ ਕੋਚ ਕੋਲ ਜਾ ਕੇ ਭੰਗੜਾ ਸਿੱਖ ਕੇ ਘਰ ਆ ਜਾਂਦਾ ਅਤੇ ਸ਼ਾਮ ਦੇ ਟਾਈਮ 'ਤੇ ਜ਼ਰੂਰ ਫਿਰ ਕੋਚ ਕੋਲ ਜਾ ਕੇ ਭੰਗੜਾ ਸਿੱਖਦਾ ਹੈ ਭੰਗੜੇ ਨੂੰ ਹੀ ਮਹੱਤਵ ਦਿੱਤੀ ਜਾਂਦੀ ਹੈ